ਜਿਵੇਂ ਕਿ ਹੁਣ ਗਰਮੀ ਦੀਆਂ ਛੁੱਟੀਆਂ ਨੇ ਅਤੇ ਸਾਡੇ ਸਾਰੇ ਫੈਮਿਲੀ ਮੈਂਬਰਸ ਅਤੇ ਰਿਲੇਟਿਵਸ ਬਹੁਤ ਜ ਜ਼ਿਆਦਾ ਹੁਣ ਇਕੱਠੇ ਹੋਏ ਨੇ ਅਤੇ ਵੈਸੇ ਤਾਂ ਸਾਰਿਆਂ ਦਾ ਸ਼ ਸ਼ਡਿਊਲ ਬਹੁਤ ਬਿਜ਼ੀ ਰਹਿੰਦਾ ਕਿ ਕੋਈ ਵੀ ਇੱਕ ਦੂਜੇ ਲਈ ਫੋਨ 'ਤੇ ਗੱਲ ਕਰਨ ਲਈ ਵੀ ਬਿਜ਼ ਫਰੀ ਨਹੀਂ ਇੰਨਾ ਕਿ ਜਸਟ ਹਾਲਚਾਲ ਪੁੱਛਣ ਲਈ ਹੀ ਫੋਨ ਹੁੰਦਾ ਉੱਦੂ ਬਾਅਦ ਇੱਦਾਂ ਦੀ ਕੋਈ ਗੱਲ ਨਹੀਂ ਹੁੰਦੀ ਬਟ ਹੁਣ ਗਰਮੀ ਦੀਆਂ ਛੁੱਟੀਆਂ ਹੋਣ ਕਰਕੇ ਅਸੀਂ ਸਾਰੇ ਰਿਸ਼ਤੇਦਾਰ ਫੈਮਿਲੀ ਮੈਂਬਰ ਸਾਰੇ ਅਸੀਂ ਰਿਲੇਟਿਵਸ ਵਗੈਰਾ ਇਕੱਠੇ ਹੋਏ ਨੇ ਜਿਸ ਕਰਕੇ ਅਸੀਂ ਘੁੰਮਣ ਫਿਰਨ ਦਾ ਪਲੈਨ ਬਣਾਇਆ ਅਸੀਂ ਪਲੈਨ ਬਣਾਇਆ ਸ਼੍ਰੀ ਮੁਕਤਸਰ ਸਾਹਿਬ ਤੋਂ ਸ਼੍ਰੀ ਹਰਿਮੰਦਰ ਸਾਹਿਬ ਤੱਕ ਦਾ ਤਾਂ ਜੋ ਕਿ ਅਸੀਂ ਉੱਥੇ ਸ਼ੀ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰ ਆਈਏ ਤਾਂ ਜੋ ਕਿ ਸਾਡੇ ਸਾਰੇ ਫੈਮਲੀ ਮੈਂਬਰਸ ਅਸੀਂ ਸਾਰੇ ਬੱਚੇ ਆਪਸ ਦੇ ਵਿੱਚ ਘੁੰਮ ਫਿਰ ਆਈਏ ਅਤੇ ਵਧੀਆ ਛੁੱਟੀਆਂ ਬਤੀਤ ਕਰ ਆਈਏ ਅਸੀਂ ਆਪਦੀਆਂ ਰੇਲਵੇ ਦੀਆਂ ਰੇਲ ਲਾਈਨ ਦੀਆਂ ਰੇਲਵੇ ਦੀਆਂ ਟਿਕਟਾਂ ਬੁੱਕ ਕਰਵਾਈਆਂ ਨੇ ਤਾਂ ਅਸੀਂ ਇਹ ਜਾਣਕਾਰੀ ਲੈਣਾ ਚਾਹੁੰਦੇ ਹਾਂ ਕਿ ਜਿਹੜੀਆਂ ਅਸੀਂ ਰੇਲ ਗੱਡੀ ਦੀਆਂ ਟਿਕਟਸ ਬੁੱਕ ਕਰਵਾਈਆਂ ਨੇ ਕੀ ਉਹ ਸਾਨੂੰ ਰੇਲ ਗੱਡੀ ਟਾਈਮ 'ਤੇ ਪ੍ਰੋਪਰ ਟਾਈਮ 'ਤੇ ਸਾਨੂੰ ਸਾਡੇ ਟਾਈਮ 'ਤੇ ਮਿਲ ਜਾਵੇਗੀ ਤਾਂ ਕਿ ਸ ਸਾਨੂੰ ਆਉਣ ਜਾਣ ਦੇ ਵਿੱਚ ਕੋਈ ਵੀ ਮੁਸ਼ਕਲ ਨਾ ਹੋਵੇ ਜੇਕਰ ਅਸੀਂ ਜਾ ਰਹੇ ਹਾਂ ਤਾਂ ਸਾਨੂੰ ਰਾਹ ਦੇ ਵਿੱਚ ਕੋਈ ਮੁਸ਼ਕਲ ਤਾਂ ਨਹੀਂ ਹੋਵੇਗੀ ਕਿਉਂਕਿ ਅਸੀਂ ਬਹੁਤ ਜਣੇ ਹਾਂ ਅਤੇ ਤਾਂ ਕਰਕੇ ਸਾਡੇ ਸਾਰੇ ਫੈਮਲੀ ਮੈਂਬਰਸ ਨੂੰ ਕੋਈ ਪ੍ਰੋਬਲਮ ਨਾ ਹੋਵੇ ਆਉਣ ਜਾਣ ਦੇ ਵਿੱਚ ਮੁਕਤਸਰ ਤੋਂ ਸ਼੍ਰੀ ਹਰਿਮੰਦਰ ਸਾਹਿਬ ਤੱਕ ਜਾਣ 'ਚ ਕੋਈ ਮੁਸ਼ਕਲ ਨਾ ਹੋਵੇ ਅਤੇ ਉੱਦੂ ਬਾਅਦ ਅਸੀਂ ਦੋ ਦਿਨ ਉੱਥੇ ਰੁਕ ਕੇ ਦੋ ਦਿਨ ਆਪਦਾ ਘੁੰਮ ਫਿਰ ਕੇ ਜਦੋਂ ਅਸੀਂ ਉੱਦੂ ਬਾਅਦ ਵਾਪਸ ਆਉਣ ਦੀਆਂ ਟਿਕਟ ਵੀ ਬੁੱਕ ਕਰਵਾ ਰੱਖੀਆਂ ਨੇ ਤਾਂ ਜੋ ਕਿ ਵਾਪਸੀ ਦੇ ਟਾਈਮ ਵੀ ਸਾਨੂੰ ਕੋਈ ਮੁਸ਼ਕਲ ਨਾ ਆਵੇ ਸਾਨੂੰ ਸਾਡੀ ਟ੍ਰੇਨ ਪ੍ਰੋਪਰ ਟਾਈਮ 'ਤੇ ਉਸ ਟਾਈਮ ਉੱਥੇ ਮਿਲ ਜਾਵੇਗੀ ਟਰੇਨ ਦਾ ਨੰਬਰ ਜੀਰੋ ਦੋ ਤਿੰਨ ਹੈ ਤਾਂ ਅਸੀਂ ਇਹ ਕਨਫਰਮ ਕਰਨਾ ਚਾਹੁੰਦੇ ਹਾਂ ਕਿ ਜਾਣ ਦੇ ਟਾਈਮ ਵੀ ਸਾਨੂੰ ਕੋਈ ਮੁਸ਼ਕਲ ਨਾ ਆਵੇ ਅਤੇ ਆਉਣ ਦੇ ਟਾਈਮ ਵੀ ਸਾਨੂੰ ਰਾਹ ਦੇ ਵਿੱਚ ਵੀ ਕੋਈ ਮੁਸ਼ਕਲ ਨਾ ਆਵੇ ਅਤੇ ਸਾਨੂੰ ਸਾਡੀ ਟ੍ਰੇਨ ਉੱਥੋਂ ਪ੍ਰੋਪਰ ਟਾਈਮ 'ਤੇ ਕਨਫਰਮ ਕਰਕੇ ਪਲੀਜ ਦੱਸ ਦਿਓ ਕਿ ਸਾਨੂੰ ਸਹੀ ਟਾਈਮ 'ਤੇ ਮਿਲ ਜਾਵੇਗੀ ਅਤੇ ਅਸੀਂ ਆਪਦਾ ਘੁੰਮ ਫਿਰ ਕੇ ਵਾਪਸ ਸਹੀ ਟਾਈਮ 'ਤੇ ਪ੍ਰੋਪਰ ਆ ਜਾਈਏ